ਪੰਜਾਬ ਵਿੱਚ ਮੁੱਖ ਸਰਕਾਰੀ ਵਿਭਾਗ ਜਾਂ ਏਜੰਸੀਆਂ ਇਹ ਹਨ ਜਿਵੇਂ ਸਿੱਖਿਆ ਸਿਹਤ ਬੁਨਿਆਦੀ ਢਾਂਚਾ ਨਿਆਂ ਇੰਗਲਿਸ਼ ਵਿੱਚ ਗੱਲ ਕਰੀਏ ਤਾਂ ਫੂਡ ਸਿਵਿਲ ਸਪਲਾਈਜ ਰੈਵੇਨਿਊ ਐਂਡ ਫੋਰੈਂਸ ਡਿਪਾਰਟਮੈਂਟ ਡੇਅਰੀ ਡਿਪੈਲਪਮੈਂਟ ਐਂਡ ਫਿਸ਼ਿਸ਼ ਡਿਪਾਰਟਮੈਂਟ ਸੋ ਇਹਨਾਂ ਵਿੱਚ ਸਾਡੇ ਅੰਮ੍ਰਿਤਸਰ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਸਰਕਾਰ ਇਹ ਬਹੁਤ ਵੱਡਾ ਆਪਣਾ ਜਿਹੜਾ ਹੈਗਾ ਹਿੱਸਾ ਯੋਗਦਾਨ ਪਾ ਰਹੀ ਹੈ ਲੋਕਾਂ ਨੂੰ ਬੇਰੁਜ਼ਗਾਰ ਲੋਕਾਂ ਨੂੰ ਕਹਿ ਲਓ ਜਾਂ ਜਿਨ੍ਹਾਂ ਦੀ ਤਨਖਾਹ ਘੱਟ ਹੈ ਉਹਨਾਂ ਨੂੰ ਕਹਿ ਲਓ ਸੌਦਾ ਜਾਂ ਰਾਸ਼ਨ ਪਾਣੀ ਸਾਰਾ ਕੁਛ ਪ੍ਰਦਾਨ ਕਰਦੀ ਹੈ ਜਿਵੇਂ ਕਣਕ ਹੋ ਗਿਆ ਜਿਨ੍ਹਾਂ ਦੇ ਇਸਤਰੀਆਂ ਦੇ ਬੀਬੀਆਂ ਦੇ ਘਰ ਵਾਲੇ ਨਹੀਂ ਹੁੰਦੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਗਲੀ ਗਲੀ ਵਿੱਚ ਉਹਨਾਂ ਨੇ ਆਪਣੇ ਡਿਪਾਰਟਮੈਂਟ ਖੋਲ੍ਹੇ ਹੁੰਦੇ ਹਨ ਅਤੇ ਲੋਕ ਜਿਹੜਾ ਹੈ ਇਹਨਾਂ ਦਾ ਆਨੰਦ ਮਾਣਦੇ ਹਨ ਲੋਕ ਸਰਕਾਰਾਂ ਨੂੰ ਵੀ ਦੁਆਵਾਂ ਦਿੰਦੇ ਹਨ ਸੋ ਇਹ ਹੀ ਚੀਜ਼ਾਂ ਹਨ ਜਿਹੜੀਆਂ ਸਰਕਾਰ ਦੀਆਂ ਮੁੱਖ ਵਿਭਾਗ ਏਜੰਸੀਆਂ ਹਨ ਜੋ ਕਿ ਥਾਂ ਥਾਂ 'ਤੇ ਖੁੱਲੀਆਂ ਹਨ